ਨਹੀਂ ਬਿਲਕੁਲ ਵੀ ਨਹੀਂ ਮੈਨੂੰ ਕੋਈ ਵੀ ਭੋਜਨ ਐਲਰਜੀ ਜਾਂ ਖੁਰਾਕ ਸੰਬੰਧਿਤ ਪਾਬੰਦੀਆਂ ਨਹੀਂ ਹਨ ਮੈਂ ਖਾਣਾ ਬਹੁਤ ਹੀ ਸਵਾਦ ਬਣਾਉਂਦੀ ਹਾਂ ਜੋ ਕਿ ਮੇਰੇ ਘਰਦਿਆਂ ਨੂੰ ਅਤੇ ਮੈਨੂੰ ਬਹੁਤ ਹੀ ਪ੍ਰੋਟੀਨ ਅਤੇ ਪੌਸ਼ਟਿਕ ਲਗਦਾ ਹੈ ਅਸੀਂ ਹਮੇਸ਼ਾ ਘਰ ਦਾ ਹੀ ਖਾਣਾ ਖਾਂਦੇ ਹਾਂ ਜਿਸ ਨਾਲ ਸਾਨੂੰ ਕੋਈ ਵੀ ਪਾਬੰਦੀ ਨਹੀਂ ਹੈ ਖਾਣਾ ਪਕਾਉਣ ਵੇਲੇ ਮੈਂ ਹਮੇਸ਼ਾ ਹੀ ਹੱਥ ਧੋ

ਇੱਕ ਹਾਈਜੀਨ ਦਾ ਤਰੀਕਾ ਹੈ ਜਿਸ ਨਾਲ ਸਭ ਖਾਣਾ ਬਹੁਤ ਹੀ ਸਵਾਦਿਸ਼ਟ ਬਣਦਾ ਹੈ ਮੈਂ ਖਾਣਾ ਬਣਾਉਣ ਵੇਲੇ ਹਰ ਸਮੇਂ ਸਾਰਾ ਧਿਆਨ ਆਪਣਾ ਖਾਣਾ ਬਣਾਉਣ ਵਿੱਚ ਹੀ ਲਗਾਉਂਦੀ ਹਾਂ ਮੈਂ ਕਿਸੇ ਹੋਰ ਵੱਲ ਧਿਆਨ ਨਹੀਂ ਕਰਦੀ ਜਿਸ ਨਾਲ ਖਾਣਾ ਬਹੁਤ ਹੀ ਪੌਸ਼ਟਿਕ ਬਣਦਾ ਹੈ ਐਲਰਜੀ ਤਾਂ ਖਾਣ ਕਈ ਖਾਣਿਆਂ ਨਾਲ ਹੁੰਦੀ ਹੈ ਬਟ ਸਾਡੇ ਘਰ ਵਿੱਚ ਸਭ ਖਾਣੇ ਸਾਨੂੰ ਬਚਪਨ ਤੋਂ ਹੀ ਖਿਲਾਏ ਜਾਂਦੇ ਹਨ ਜਿਸ ਨਾਲ ਸਾਨੂੰ ਕੋਈ ਵੀ ਐਲਰਜੀ ਜਾਂ ਖੁਰਾਕ ਸੰਬੰਧਿਤ ਪਾਬੰਦੀਆਂ ਨਹੀਂ ਹਨ ਅਸੀਂ ਬੜੀ ਹੀ ਆਸਾਨੀ ਨਾਲ ਹਰ ਇੱਕ ਭੋਜਨ ਨੂੰ ਖਾ ਸਕਦੇ ਹਾਂ ਜਿਸ ਨਾਲ ਸਾਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਅਤੇ ਅਸੀਂ ਆਸਾਨੀ ਨਾਲ ਹੀ ਆਪਣਾ ਭੋਜਨ ਗ੍ਰਹਿਣ ਕਰਦੇ ਹਾਂ ਸਾਨੂੰ ਬਿਲਕੁਲ ਵੀ ਬਾਹਰ ਦਾ ਨਹੀਂ ਖਾਣਾ ਚਾਹੀਦਾ ਜਿਸ ਨਾਲ ਕਿ ਸਾਨੂੰ ਐਲਰਜੀ ਜਾਂ ਖੁਰਾਕ ਸੰਬੰਧਿਤ ਪਾਬੰਦੀਆਂ ਲੱਗ ਜਾਣ ਇਸ ਕਰਕੇ ਹਮੇਸ਼ਾ ਹੀ ਸਾਨੂੰ ਘਰ ਦਾ ਹੀ ਖਾਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਆਪਣੇ ਘਰ ਦਾ ਭੋਜਨ ਬਹੁਤ ਹੀ ਵਧੀਆ ਤਰੀਕੇ ਨਾਲ ਹੱਥ ਧੋ ਕੇ ਅਤੇ ਆਪਣੀ ਸਾਫ ਸਫਾਈ ਕਰਕੇ ਬਣਾਉਂਦੇ ਹਾਂ ਬਾਹਰ ਦਾ ਖਾਣਾ ਉਸ ਤਰ੍ਹਾਂ ਨਹੀਂ ਬਣਾਇਆ ਜਾਂਦਾ ਜਿਸ ਨਾਲ ਕਿ ਕਈ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਇਸ ਨਾਲ ਐਲਰਜੀ ਅਤੇ ਖੁਰਾਕ ਸੰਬੰਧੀ ਪਾਬੰਦੀਆਂ ਕਈਆਂ ਨੂੰ ਲੱਗ ਜਾਂਦੀਆਂ ਹਨ ਧੰਨਵਾਦ